ਹੈਲੋ ਸਰ ਮੈਂ ਫਲਿਪਕਾਰਟ ਤੋਂ ਰੀਸੈਂਟਲੀ ਪਰਸੋਂ ਇੱਕ ਪ੍ਰਿੰਟਰ ਔਡਰ ਕੀਤਾ ਸੀ ਅਤੇ ਮੈਂ ਜਿਹੜਾ ਪ੍ਰਿੰਟਰ ਔਡਰ ਕੀਤਾ ਸੀਗਾ ਉਹ ਮੈਂ ਔਡਰ ਕੀਤਾ ਸੀ ਐੱਚ ਪੀ ਕੰਪਨੀ ਦਾ ਔਡਰ ਕੀਤਾ ਸੀ ਬਟ ਮੈਨੂੰ ਜਿਹੜਾ ਪ੍ਰਿੰਟਰ ਮਿਲਿਆ ਉਹ ਹੈ ਕੈਨਨ ਦਾ ਮਿਲਿਆ ਉਸ ਤੋਂ ਬਾਅਦ ਜਦੋਂ ਮੈਂ ਉਹਨੂੰ ਖੋਲ੍ਹ ਕੇ ਵੇਖਿਆ ਤਾਂ ਸਭ ਤੋਂ ਪਹਿਲਾਂ ਉਸਦੀ ਪੈਕਿੰਗ ਬਹੁਤ ਜ਼ਿਆਦਾ ਖਰਾਬ ਹਾਲਤ ਦੇ ਵਿੱਚ ਸੀ ਅਤੇ ਉਹ ਪ੍ਰੋਪਰਲੀ ਜਦੋਂ ਉਹਨੂੰ ਮੈਂ ਚਲਾ ਕੇ ਵੀ ਵੇਖਿਆ ਮੈਂ ਔਡਰ ਕੀਤਾ ਸੀਗਾ ਬਲੈਕ ਐਂਡ ਵਾਈਟ ਅਤੇ ਕਲਰਫੁਲ ਪ੍ਰਿੰਟਰ ਔਡਰ ਕੀਤਾ ਸੀ ਬਟ ਜਿਹੜਾ ਪ੍ਰਿੰਟਰ ਮੈਨੂੰ ਰਿਸੀਵ ਹੋਇਆ ਉਹ ਸਿਰਫ ਬਲੈਕ ਐਂਡ ਵਾਈਟ ਹੀ ਹੈ ਅਤੇ ਉਸ ਵਿੱਚ ਕਲਰਫੁਲ ਇੰਕ ਯੂਸ ਨਹੀਂ ਹੁੰਦੀ ਅਤੇ ਉਸ ਤੋਂ ਬਾਅਦ ਜਦੋਂ ਮੈਂ ਪੇਜ਼ਿਸ ਦੀ ਦੇਖਦੀ ਹਾਂ ਤਾਂ ਪੇਜ਼ਿਸ ਉਸ ਦੇ ਵਿੱਚ ਸਟੱਕ ਹੋ ਜਾਂਦੇ ਆ ਉਹ ਪ੍ਰੋਪਰਲੀ ਚੱਲਦਾ ਨਹੀਂ ਹੈ ਅਤੇ ਜਦੋਂ ਉਹ ਪ੍ਰਿੰਟਿੰਗ ਵੀ ਕਰਦਾ ਇਕੱਲੀ ਬਲੈਕ ਐਂਡ ਵਾਈਟ ਵੀ ਕਰਦਾ ਹੈ ਤਾਂ ਸਿਰਫ ਉਹ ਜਿਹੜੇ ਹੁੰਦੇ ਨੇ ਕੁਛ ਲੈਟਰਸ ਉਹ ਮਿਸਪ੍ਰਿੰਟ ਕਰ ਦਿੰਦਾ ਹੈ ਅਤੇ ਉਹ ਪ੍ਰੋਪਰਲੀ ਉਹ ਵੀ ਵਰਕ ਨਹੀਂ ਕਰ ਰਿਹਾ ਅਤੇ ਐਟ ਦ ਐਂਡ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਇਹ ਫਸਟ ਟਾਈਮ ਇੰਨਾ ਜ਼ਿਆਦਾ ਬੈਡ ਐਕਸਪੀਰੀਅੰਸ ਰਿਹਾ ਤੁਹਾਡੀ ਕੰਪਨੀ ਦੇ ਨਾਲ ਹੁਣ ਮੈਂ ਸਿਰਫ ਇੱਕ ਰਿਵਰਟ ਦੀ ਵੇਟ ਕਰ ਰਹੀ ਹਾਂ ਕਿ ਕਦੋਂ ਇਹ ਪ੍ਰਿੰਟਰ ਹੈ ਜਿਹੜਾ ਇਹ ਰਿਪਲੇਸ ਹੋ ਕੇ ਜੋ ਮੈਂ ਪ੍ਰਿੰਟਰ ਔਡਰ ਕੀਤਾ ਸੀਗਾ ਉਹ ਮੈਨੂੰ ਦੁਬਾਰਾ ਸੈਂਡ ਹੋਊਗਾ